ਸਾਡੇ ਰਾਜ ਵਿੱਚ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਅਸਥਾਨ ਹਨ ਜਿਵੇਂ ਕਿ ਗੁਰਦੁਆਰੇ ਵੀ ਹਨ ਮੰਦਰ ਵੀ ਮਸਜਿਦ ਵੀ ਚਰਚ ਵੀ ਹਨ ਪਰ ਅਸੀਂ ਜ਼ਿਆਦਾਤਰ ਗੁਰਦੁਆਰਾ ਸਾਹਿਬ ਜਾਂਦੇ ਹਨ ਅਸੀਂ ਗੁਰਦੁਆਰਾ ਸਾਹਿਬ ਜੋ ਸਾਡੇ ਲੋਕਲ ਪਿੰਡ ਦਾ ਗੁਰਦੁਆਰਾ ਹੈ ਉੱਥੇ ਤਾਂ ਅਸੀਂ ਸਵੇਰੇ ਸ਼ਾਮ ਜਾਂਦੇ ਹਨ ਅਤੇ ਉੱਥੇ ਜਾ ਕੇ ਸਾਨੂੰ ਪਾਠ ਕਰਨਾ ਅਤੇ ਪਾਠ ਸੁਣਨਾ ਬਹੁਤ ਜਿਆਦਾ ਵਧੀਆ ਲੱਗਦਾ ਹੈ ਅਤੇ ਜੋ ਸਾਡੇ ਪ੍ਰਮੁੱਖ ਗੁਰਦੁਆਰੇ ਸਾ ਸਾਡੇ ਰਾਜ ਦੇ ਪ੍ਰਮੁੱਖ ਗੁਰਦੁਆਰੇ ਸਾਹਿਬਾਨ ਹਨ ਜਿਵੇਂ ਕਿ ਸੋਹਾਣਾ ਸਾਹਿਬ ਸਿੰਘ ਸ਼ਹੀਦਾਂ ਦਾ ਗੁਰਦੁਆਰਾ ਹੈ ਉੱਥੇ ਸਾਨੂੰ ਜਾਣਾ ਵਧੀਆ ਲੱਗਦਾ ਉੱਥੇ ਅਸੀਂ ਜਿਵੇਂ ਸੰਗਰਾਂਦ ਦੇ ਦਿਹਾੜੇ 'ਤੇ ਜਾਂ ਪੂਰਨਮਾਸ਼ੀ ਦੇ ਦਿਹਾੜੇ 'ਤੇ ਅਸੀਂ ਜਾਨੇ ਆ ਅਤੇ ਉੱਥੇ ਜਾ ਕੇ ਸਾਨੂੰ ਪਾਠ ਸੁਣਨਾ ਅਤੇ ਕੀਰਤਨ ਸੁਣਨਾ ਸਾਨੂੰ ਸਭ ਤੋਂ ਜਿਆਦਾ ਆਨੰਦਮਈ ਲੱਗਦਾ ਹੈ